ਮੈਂ ਅੰਸ਼ੁਲ ਮੈਂ ਪਠਾਨਕੋਟ ਦਾ ਰਹਿਣ ਵਾਲਾ ਹਾਂ ਤਾਂ ਸਾਡੇ ਖੇਤਰ ਵਿੱਚ ਲੋਕ ਮੇਰੇ ਖਿਆਲ 'ਚ ਜ਼ਿਆਦਾਤਰ ਪਹਿਲਾਂ ਤਾਂ ਮੈਂ ਗੱਲ ਕਰਾਂਗਾ ਐਂਡਰਾਇਡ ਫੋਨਾਂ ਦਾ ਯੂਜ ਕਰਦੇ ਨੇ ਅਤੇ ਕਈ ਲੋਕ ਆਈਫੋਨ ਵੀ ਯੂਜ ਕਰਦੇ ਨੇ ਤਾਂ ਜੇ ਮੈਂ ਗੱਲ ਕਰਾਂ ਟੈਲੀਫੋਨ ਬਰਾਡਾਂ ਦੀ ਤਾਂ ਸਭ ਤੋਂ ਪਹਿਲਾਂ ਮੇਰੇ ਦਿਮਾਗ ਵਿੱਚ ਜ਼ਿਆਦਾਤਰ ਨਾਮ ਆਉਂਦਾ ਹੈ ਰੈਡਮੀ ਜਾਂ ਐਮ ਆਈ ਦਾ ਕਿਉਂਕਿ ਜ਼ਿਆਦਾਤਰ ਇੱਥੋਂ ਦੇ ਲੋਕਾਂ ਕੋਲ ਮੈਂ ਰੈਡਮੀ ਦੇ ਫੋਨ ਵੇਖੇ ਨੇ ਕਿਉਂਕਿ ਇੱਕ ਤਾਂ ਰੈਡਮੀ ਦੇ ਫੋਨ ਉਹਨਾਂ ਨੂੰ ਬਿਲਕੁਲ ਸਹੀ ਉਹਨਾਂ ਦੇ ਬਜਟ ਵਿੱਚ ਮਿਲ ਜਾਂਦੇ ਨੇ ਉਸ ਤੋਂ ਬਾਅਦ ਰੈਡਮੀ ਦੇ ਫੋਨਾਂ ਵਿੱਚ ਕਾਫੀ ਕਲਰ ਵੀ ਬੇਰੀਐਂਟ ਮਿਲ ਜਾਂਦਾ ਵੱਖਰਾ ਵੱਖਰਾ ਅਤੇ ਉਸ ਤੋਂ ਬਾਅਦ ਰੈਡਮੀ ਦੇ ਫੋਨਾਂ ਦੀ ਜੇ ਅਸੀਂ ਗੱਲ ਕਰੀਏ ਇਸ ਵਿੱਚ ਕਾਫੀ ਨਵੇਂ ਫੀਚਰ ਵੀ ਹੈਗੇ ਹਨ ਇਸ ਦੀ ਕੈਮਰਾ ਕੁਆਲਿਟੀ ਵੀ ਬਹੁਤ ਵਧੀਆ ਅਤੇ ਰੈਡਮੀ ਦਾ ਫੋਨ ਇੱਕ ਆਮ ਆਦਮੀ ਤੋਂ ਲੈ ਕੇ ਇੱਕ ਜੋ ਕਿ ਬਿਜ਼ਨੈਸਮੈਨ ਹੈ ਉਹ ਵੀ ਖਰੀਦ ਸਕਦਾ ਅਤੇ ਕਿਉਂਕਿ ਰੈਡਮੀ ਨੇ ਹਰ ਟਾਈਪ ਦੇ ਮੋਡਲ ਲਾਂਚ ਕੀਤੇ ਹੋਏ ਹਨ ਅਤੇ ਇਹ ਕਾਫੀ ਬੈਨੀਫਿਟ ਦਿੰਦਾ ਹਰ ਇੱਕ ਟਾਈਪ ਦੇ ਇਨਸਾਨ ਨੂੰ ਤਾਂ ਜੇ ਮੈਂ ਆਪਣੀ ਗੱਲ ਕਰਾਂ ਤਾਂ ਮੇਰੇ ਕੋਲ ਵੀ ਰੈਡਮੀ ਦਾ ਹੀ ਇੱਕ ਫੋਨ ਹੈ ਰੈਡਮੀ ਫਾਈਵ ਤਾਂ ਇਹ ਮੇਰੇ ਕੋਲ ਕਈ ਸਾਲਾਂ ਤੋਂ ਹੈ ਅਤੇ ਇਸ ਫੋਨ ਤੋਂ ਮੈਂ ਬਹੁਤ ਸੰਤੁਸ਼ਟ ਹਾਂ ਕਿਉਂਕਿ ਇਸ ਫੋਨ ਨੇ ਮੇਰਾ ਬਹੁਤ ਸਾਥ ਦਿੱਤਾ ਅੱਜ ਤੱਕ ਅਤੇ ਜੋ ਵੀ ਮੈਂ ਮਤਲਬ ਕੰਮ ਕਰ ਕਰ ਰਿਹਾ ਜਿੱਦਾਂ ਔਨਲਾਈਨ ਕੋਈ ਕੰਮ ਕਰਦਾ ਤਾਂ ਇਹ ਫੋਨ ਮੈਨੂੰ ਬਹੁਤ ਸਾਥ ਦਿੰਦਾ ਜਿਵੇਂ ਕਿ ਹਰ ਟਾਈਪ ਦਾ ਕੰਮ ਜਿੱਦਾਂ ਜੋ ਜਿੱਥੇ ਵੀ ਅਸੀਂ ਜਿੱਦਾਂ ਹੁਣ ਅਸੀਂ ਪੜ੍ਹਦੇ ਹਾਂ ਅਤੇ ਅਸੀਂ ਇਸ ਤੋਂ ਹਰ ਢੰਗ ਦੀ ਸਹੂਲਤ ਲੈ ਸਕਦੇ ਹਾਂ ਅਤੇ ਜਿੱਦਾਂ ਅਸੀਂ ਕੋਈ ਡਾਊਟ ਆਉਂਦਾ ਸਾਨੂੰ ਤਾਂ ਅਸੀਂ ਇਸ ਦੀ ਸਹੂਲਤ ਲੈਂਦੇ ਹਾਂ ਅਤੇ ਅਸੀਂ ਜੇ ਸਾਨੂੰ ਅਸੀਂ ਟੀਚਰ ਨਾਲ ਗੱਲ ਕਰਨੀ ਆ ਅਸੀਂ ਟੀਚਰ ਨੂੰ ਕੌਲ ਕਰ ਸਕਦੇ ਹਾਂ ਅਤੇ ਮਤਲਬ ਕਿ ਹਰ ਟਾਈਪ ਦੀ ਸਹੂਲਤ ਇਸਨੇ ਮੈਨੂੰ ਦਿੱਤੀ ਹੈ ਤਾਂ ਜੇ ਮੈਂ ਗੱਲ ਕਰਾਂ ਕਿ ਕਿਹੜੀਆਂ ਕਿਹੜੀਆਂ ਵਿਸ਼ੇਸ਼ਤਾਵਾਂ ਹਨ ਜੋ ਮੈਂ ਚਾਹੁੰਦਾ ਹਾਂ ਫੋਨ 'ਚ ਹੋਣੀਆਂ ਹੀ ਚਾਹੀਦੀਆਂ ਹਨ ਸਭ ਤੋਂ ਪਹਿਲਾਂ ਮੇਰੇ ਹਿਸਾਬ ਨਾਲ ਤਾਂ ਫੋਨ 'ਚ ਜ਼ਿਆਦਾ ਤੋਂ ਜ਼ਿਆਦਾ ਸਟੋਰੇਜ ਹੋਣੀ ਚਾਹੀਦੀ ਹੈ ਕਿ ਜਿਸਦੇ ਵਿੱਚ ਅਸੀਂ ਆਪਣੀ ਇੰਪੋਰਟੈਂਟ ਫਾਈਲਾਂ ਵਗੈਰਾ ਸਟੋਰ ਕਰਕੇ ਰੱਖੀਏ ਉਸ ਤੋਂ ਬਾਅਦ ਗੱਲ ਮੇਰੇ ਦਿਮਾਗ 'ਚੋਂ ਆ ਰਹੀ ਹੈ ਉਹ ਹੈ ਕਿ ਅੱਜ ਕੱਲ ਜੇ ਮੈਂ ਦੇਖਿਆ ਕਿ ਕਈ ਫੋਨ ਹੈਂਗ ਬਹੁਤ ਛੇਤੀ ਹੋਣ ਲੱਗ ਪੈਂਦੇ ਹਨ ਤਾਂ ਫੋਨ ਹੈਂਗ ਹੋਣ ਦੀ ਸਮੱਸਿਆ ਦੂਰ ਕਰਨੀ ਚਾਹੀਦੀ ਹੈ ਅਤੇ ਉਸ ਤੋਂ ਬਾਅਦ ਅਗਲੀ ਗੱਲ ਆ ਕਿ ਕੈਮਰਾ ਕੁਆਲਿਟੀ ਕਾਫੀ ਅੱਛੀ ਹੋਣੀ ਚਾਹੀਦੀ ਹੈ ਅਤੇ ਬਾਕੀ ਗੱਲ ਰਹੀ ਉਸਦੇ ਫੀਚਰ ਦੀ ਤਾਂ ਉਸ ਵਿੱਚ ਕਾਫੀ ਮਤਲਬ ਅੱਜ ਦੇ ਜ਼ਮਾਨੇ ਦੇ ਨਵੇਂ ਫੀਚਰ ਹੋਰ ਐਡ ਕਰਨੇ ਚਾਹੀਦੇ ਹਨ ਇਹ ਵਿਸ਼ੇਸ਼ਤਾਵਾਂ ਤਾਂ ਹੋਣੀਆਂ ਹੀ ਚਾਹੀਦੀਆਂ ਹਨ ਕਿ ਜੋ ਸਾਨੂੰ ਸਹੀ ਮੌਕੇ 'ਤੇ ਕੰਮ ਆ ਸਕਣ ਅਤੇ ਬਾਕੀ ਆ ਜਿੱਦਾਂ ਉਹਦੇ ਵਿੱਚ ਪਹਿਲਾਂ ਹੀ ਅੱਜ ਕੱਲ ਦੇਖਦੇ ਹਾਂ ਕਿ ਪਹਿਲਾਂ ਹੀ ਹੈਲਪਲਾਈਨ ਨੰਬਰ ਵਗੈਰਾ ਪਹਿਲਾਂ ਹੀ ਫੀਡ ਹੁੰਦੇ ਆ ਇਹ ਵੀ ਹੋਣੇ ਚਾਹੀਦੇ ਹਨ ਕਿ ਕਿਉਂਕਿ ਕਦੇ ਵੀ ਕਿਸੇ ਨੂੰ ਵੀ ਕਿਸੇ ਸਮੇਂ ਵੀ ਲੋੜ ਪੈ ਸਕਦੀ ਹੈ ਐਮਰਜੈਂਸੀ ਵਕਤ ਅਤੇ ਮਤਲਬ ਕਿ ਜੋ ਖਾਸ ਖਾਸ ਨਵੀਆਂ ਨਵੀਆਂ ਚੀਜ਼ਾਂ ਨੇ ਉਹ ਤਾਂ ਹੋਣੀਆਂ ਚਾਹੀਦੀਆਂ ਹਨ ਅਤੇ ਜੇ ਗੱਲ ਕਰੀਏ ਜਿੱਦਾਂ ਅੱਜ ਕੱਲ ਟੈਕਨੋਲੋਜੀ ਬਹੁਤ ਅੱਗੇ ਜਾ ਰਹੀ ਹੈ ਤਾਂ ਫੋਨਾਂ 'ਚ ਹੁਣ ਏ ਆਈ ਵੀ ਆ ਰਿਹਾ ਅਤੇ ਏ ਆਈ ਵੀ ਫੋਨਾਂ 'ਚ ਹੁਣ ਹੁਣ ਐਡ ਹੋਣਾ ਚਾਹੀਦਾ